ਮੈਂ ਅੱਜ ਤੋਂ ਕੁਝ ਸਮੇਂ ਪਹਿਲਾਂ ਔਨਲਾਈਨ ਜੁੱਤੀ ਖਰੀਦੀ ਸੀ ਅਤੇ ਜਦੋਂ ਉਸਨੂੰ ਮੈਂ ਪਾਇਆ ਅਤੇ ਉਹ ਖ਼ਰਾਬ ਹੋ ਗਈ ਸੀ ਅਤੇ ਜਦੋਂ ਉਹ ਮੈਂ ਲਈ ਸੀ ਉਸ ਲਏ ਨੂੰ ਉਸਨੂੰ ਕਾਫੀ ਸਮਾਂ ਹੋ ਗਿਆ ਸੀ ਜਿਸ ਕਰਕੇ ਔਨਲਾਈਨ ਸ਼ੋਪਿੰਗ ਵਾਲਿਆਂ ਨੇ ਉਸਨੂੰ ਨਹੀਂ ਵਾਪਸ ਲਿਆ ਸੀ